ਹਾਂਜੀ ਬਿਲਕੁਲ ਜਨਾਬ ਕਦੋਂ ਆਏ ਸੀ ਜੀ ਬੱਚੇ ਕਿੰਨ ਕਿੰਨੀ ਕਿੰਨੀ ਕੀਮਤ ਸੀ ਕਿਤਾਬ ਦੀ ਕਿੰਨੀ ਕੀਮਤ ਸੀ ਕਿਤਾਬ ਦੀ ਅੱਛਾ ਸਿਲੇਬਸ ਸਿਲੇਬਸ ਦੀ ਬੁੱਕ ਆ ਕੋਈ ਅੱਛਾ ਹਾਂਜੀ ਹਾਂਜੀ ਆਏ ਸੀ ਬੱਚੇ ਅਤੇ ਨਹੀਂ ਕਿਤਾਬ ਕੀ ਸਮੱਸਿਆ ਆਈ ਹੈ ਤੁਹਾਨੂੰ ਕਿਤਾਬ ਦੀ ਨਹੀਂ ਬੱਚੇ ਇੱਥੋਂ ਦੇਖ ਕੇ ਨਹੀਂ ਲੈ ਕੇ ਗਏ ਕਿਤਾਬ ਨੂੰ ਇਹ ਤਾਂ ਫਿਰ ਤੁਹਾਡਾ ਬਣਦਾ ਸੀ ਨਾ ਦੇਖਣੀ ਸੀ ਬੱਚਿਆਂ ਨੇ ਕਿਤਾਬ ਅਤੇ ਇਸ ਤਰ੍ਹਾਂ ਤਾਂ ਕੋਈ ਹਰ ਕੋਈ ਪਹਿਲੀ ਕੰਪਲੇਂਟ ਹੈ ਇਸ ਤਰ੍ਹਾਂ ਤਾਂ ਫਿਰ ਆਈ ਨਹੀਂ ਕੰਪਲੇਂਟ ਹੁਣ ਤੱਕ ਕਿ ਕਿਤਾਬ ਫਟੀ ਹੋਵੇ ਵਾਪਸ ਕਰਨ ਦਾ ਤਾਂ ਜੀ ਤੁਹਾਨੂੰ ਵਾ ਵਾਪਸ ਕਰਕੇ ਬਦਲ ਕੇ ਲੈਣੀ ਹੈ ਤੁਸੀਂ ਜਾ ਤੁਸੀਂ ਲੈਣੀ ਹੈ ਕਿਤਾਬ ਪੈਸੇ ਪੈਸੇ ਤਾਂ ਨਹੀਂ ਜੀ ਹੋ ਸਕਦਾ ਪੈਸੇ ਤੁਸੀਂ ਕਿਤਾਬ ਤੁਹਾਨੂੰ ਨਵੀਂ ਦੇ ਦੇਵਾਂਗੇ ਅਸੀਂ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਰਿਟਰਨ ਕਰਕੇ ਆ ਸਕਦੇ ਹੋ ਓ ਓਕੇ ਜੀ ਓਕੇ ਮਿਹਰਬਾਨੀ ਓਕੇ ਜੀ ਓਕੇ